ਸਾਡੇ ਇਲਾਕੇ ਦੇ ਜੀ ਰਾਸ਼ਟਰੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇਣ ਦਾ ਮਾਧਿਅਮ ਤਾਂ ਸਕੂਲ ਅਤੇ ਕੋਲਜ ਹੀ ਹਨ ਸਕੂਲਾਂ ਦੇ ਵਿੱਚ ਅਤੇ ਕੋਲਜਾਂ ਦੇ ਵਿੱਚ ਇੱਦਾਂ ਦੇ ਜਿਹੜੇ ਹੈਗੇ ਹੈ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਨੇ ਜਿੱਥੋਂ ਬੱਚਿਆਂ ਨੂੰ ਪਤਾ ਲੱਗਦਾ ਵੀ ਅਸੀਂ ਇਹ ਨਾ ਜਿਹੜੇ ਸੰਸ ਪ੍ਰੀਖਿਆ ਦੇ ਵਿੱਚ ਭਾਗ ਦੇਣਾ ਅਧਿਆਪਕ ਜਿਹੜੇ ਨੇ ਉੱਥੋਂ ਦੇ ਉਹ ਉਹਨਾਂ ਨੂੰ ਬੱਚਿਆਂ ਨੂੰ ਦੱਸਦੇ ਨੇ ਸਮੇਂ ਸਮੇਂ 'ਤੇ ਵੀ ਇਹ ਹੁਣ ਪੋਰਟਲ ਖੁੱਲ੍ਹਿਆ ਅਤੇ ਤੁਸੀਂ ਇਹਦੇ 'ਚ ਉਹਨਾਂ ਦੇ ਫਾਰਮ ਭਰਾਉਂਦੇ ਨੇ ਅਤੇ ਉਹਤੋਂ ਬਾਅਦ ਜੀ ਉਹਨਾਂ ਦੀ ਤਿਆਰੀ ਦਾ ਵੀ ਜਿੰਮਾ ਹੁੰਦਾ ਅਧਿਆਪਕਾਂ ਦੇ ਜਿਵੇਂ ਬੜੇ ਸਾਰੇ ਸਕੂਲ ਕੋਲਜ ਮਦਦ ਕਰਦੇ ਨੇ ਅਤੇ ਉਹਦੇ ਉਹਨਾਂ ਦੇ ਰਾਹੀਂ ਉਸ ਸੰਸਥਾਵਾਂ ਦੇ ਰਾਹੀਂ ਜਿਹੜੇ ਬੱਚੇ ਨੇ ਭਰਤੀ ਪ੍ਰਕਿਰਿਆ ਹੈ ਜਾਂ ਪ੍ਰੀਖਿਆ ਦੇ ਵਿੱਚ ਜਿਹੜਾ ਅਪੀਅਰ ਹੁੰਦੇ ਨੇ